ਸਤਿ ਸ਼੍ਰੀ ਅਕਾਲ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਕਈ ਸੰਸਥਾਵਾਂ ਹੈ ਜੋ ਫੋਟੋਗ੍ਰਾਫੀ ਦੀ ਡਿਗਰੀ ਪ੍ਰਾਪਤ ਅਸੀਂ ਕਰ ਸਕਦੇ ਹਾਂ ਇੰਡੀਆ ਵਿੱਚ ਜੋ ਇੰਸੀਟਿਊਟ ਜਾਂ ਸੰਸਥਾਵਾਂ ਫੋਟੋਗ੍ਰਾਫੀ ਦੀ ਡਿਗਰੀ ਦਿੰਦੇ ਆ ਉਹਨਾਂ ਵਿੱਚ ਹੈ ਨਿਊ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਇਹ ਵਿਜ਼ੂਅਲ ਕਮਿਊਨੀਕੇਸ਼ਨ ਦੇ ਤਹਿਤ ਫੋਟੋਗ੍ਰਾਫੀ ਦਾ ਕੋਰਸ ਅਵੇਲੇਬਲ ਹੈ ਇੱਥੇ ਦੂਜੀ ਅਹਿਮਦਾਬਾਦ ਦੀ ਨੈਸ਼ਨਲ ਇੰਸਟੀਟਿਊਟ ਔਫ ਡਿਜ਼ਾਇਨ ਇਹਦੇ ਵਿੱਚ ਕਮਿਊਨੀਕੇਸ਼ਨ ਡਿਜ਼ਾਇਨ ਦੇ ਅਧਾਰਿਤ 'ਤੇ ਫੋਟੋਗ੍ਰਾਫੀ ਦੀ ਪੜ੍ਹਾਈ ਕਰਵਾਈ ਜਾਂਦੀ ਆ ਤੀਜੀ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਔਫ ਇੰਡੀਆ ਐਟ ਪੁਣੇ ਇਹਦੇ ਵਿੱਚ ਸਿਨਮੈਟੋਗ੍ਰਾਫਿਕ ਅਧਾਰਿਤ 'ਤੇ ਫੋਟੋਗ੍ਰਾਫੀ ਦਾ ਤਜ਼ੁਰਬਾ ਮਿਲਦਾ ਹੈ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਈ ਸਾਰੀ ਸੰਸਥਾਵਾਂ ਹੈ ਜੋ ਸਾਨੂੰ ਫੋਟੋਗ੍ਰਾਫੀ ਦੀ ਡਿਗਰੀ ਪ੍ਰਦਾਨ ਕਰਦੇ ਹੈਗੇ ਆ ਉਹਨਾਂ 'ਚ ਹੈਗੀ ਆ ਯੂ ਐੱਸ ਏ ਦੀ ਨਿਊਯੋਰਕ ਫਿਲਮ ਅਕੈਡਮੀ ਦੂਜੀ ਯੂ ਕੇ ਦੀ ਲੰਡਨ ਕੋਲੇਜ ਔਫ ਕਮਿਊਨੀਕੇਸ਼ਨ ਤੀਜੀ ਕੈਨੇਡਾ ਦੀ ਰਾਇਰਸਨ ਯੂਨੀਵਰਸਿਟੀ ਚੌਥੀ ਆਸਟ੍ਰੇਲੀਆ ਦੀ ਮੈਲਬੋਰਨ ਪੋਲੀਟੈਕਨਿਕ ਧੰਨਵਾਦ ਜੀ